ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੀ ਕਿਵੇਂ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦੀ ਹਾਂ

ਹਾਂਜੀ ਹਾਂਜੀ ਹਾਂਜੀ ਅਤੇ ਜਿਹੜਾ ਜਿਹੜਾ ਤੁਸੀਂ ਰਹਿਣ ਸਹਿਣ ਦਾ ਕਹਿ ਰਹੇ ਹਾਂ ਸਾਡੇ ਇੱਥੇ ਰਹਿਣ ਸਹਿਣ ਦਾ ਬਹੁਤ ਵਧੀਆ ਪ੍ਰੋਗਰਾਮ ਹੈਗਾ ਹੈ ਬਹੁਤ ਵਧੀਆ ਹੋਟਲਸ ਬਣੇ ਹੋਏ ਨੇ ਉੱਥੇ ਤੁਸੀਂ ਇੱਕ ਕਮਰਾ ਬੁੱਕ ਕਰ ਸਕਦੇ ਹੋ ਉਹ ਵੀ ਜੇ ਤੁਸੀਂ ਤੁਸੀਂ ਮਿਨੀਮਮ ਕੋਸਟ 'ਤੇ ਬ ਬ ਜਿਹੜਾ ਅ ਬੁੱਕ ਕਰਨ ਦੀ ਕ ਜਿਹੜਾ ਕਮਰਾ ਹੈ ਹੋਟਲ ਦਾ ਉਹ ਬੁੱਕ ਕਰਨਾ ਚਾਹ ਰਹੇ ਹੋ ਜੇ ਚ ਮਿਨੀਮਮ ਕੋਸਟ 'ਤੇ ਤੁਸੀਂ ਉਹ ਵੀ ਕਰ ਸਕਦੇ ਹੋ ਅਤੇ ਜਿਹੜਾ ਤੁਸੀਂ ਟ੍ਰਾਂਸਪੋਟੇਸ਼ਨ ਦੀ ਗੱਲ ਕਰ ਰਹੇ ਸੀਗੇ ਇੱਥੇ ਟ੍ਰਾਂਸਪੋਟੇਸ਼ਨ ਜਿਹੜੀਆਂ ਸਰਵਿਸਿਜ ਨੇ ਉਹ ਵੀ ਬਹੁਤ ਵਧੀਆ ਨੇ ਜਿਵੇਂ ਤੁਸੀਂ ਮੰਨ ਲਓ ਤੁਸੀਂ ਇੱਕ ਕੈਬ ਕੈਬ ਬੁੱਕ ਕੀਤੀ ਹੋਈ ਹੈ ਹੈ ਨਾ ਜੇ ਤੁਸੀਂ ਉਸ ਕੈਬ ਵਿੱਚ ਹੁਣ ਨਹੀਂ ਤੁਹਾਡਾ ਮਨ ਬਦਲ ਗਿਆ ਕਿ ਤੁਸੀਂ ਹੁਣ ਕੈਬ 'ਚ ਨਹੀਂ ਜਾਣਾ ਫਿਰ ਤੁਸੀਂ ਓਸੇ ਟਾਈਮ ਓਸੇ ਟਾਈਮ ਹੀ ਤੁਸੀਂ ਉਹ ਬੁਕਿੰਗ ਕੈਂਸਲ ਵੀ ਕਰ ਸਕਦੇ ਹੋ ਇਹ ਜਿਹੜੀਆਂ ਸਰਵਿਸਿਜ ਨੇ ਇਹ ਇਹ ਜਿਹੜੀਆਂ ਕੈਬ ਡ੍ਰਾਇਵਰਸ ਨੇ ਉਨ੍ਹਾਂ ਨੇ ਇੱਕ ਐੱਪ 'ਤੇ ਇਹ ਸਰਵਿਸਿਜ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਓ ਓਸੇ ਓਸੇ ਟਾਈਮ ਬੁਕਿੰਗ ਕੈਂਸਲ ਵੀ ਕਰ ਸਕਦੇ ਹੋ ਜੇ ਤੁਸੀਂ ਉਹਨੂੰ ਫਿਰ ਬੁੱਕ ਕਰਨਾ ਫਿਰ ਬੁੱਕ ਵੀ ਕਰ ਸਕਦੇ ਹੋ ਇਹ ਸਾਡੀਆਂ ਟਰਾਂਪੋਰਟੇਸ਼ਨ ਸਰਵਿਸਿਸ ਹੋ ਗਈਆਂ ਹੋਰ ਤੁਸੀਂ ਕੀ ਪੁੱਛ ਰਹੇ ਸੀ

ਹਾਂਜੀ ਮੈਨੂੰ ਸਮਝ ਨਹੀਂ ਲੱਗ ਰਹੀ ਹੈ ਓਕੇ ਓਕੇ ਤੁਸੀਂ ਇਨਾਂ ਨੂੰ ਤੁਸੀਂ ਕਿਸੇ ਵੀ ਇੰਡੀਆ ਦੇ ਕਿਸੇ ਵੀ ਹੋਟਲ 'ਚ ਜਾ ਕੇ ਲੈ ਸਕਦੇ ਇਹਨਾਂ ਦੀਆਂ ਸਰਵਿਸਿਸ ਹਾਂਜੀ ਤੁਸੀਂ ਕਿਤੇ ਵੀ ਪੁਛੋਂਗੇ ਅਸੀਂ ਤੁਹਾਨੂੰ ਮਨਾਂ ਨਹੀਂ ਕਰਨਾ ਕਰੂਗਾ ਕੋਈ ਹਾਂਜੀ ਟਰਾਂਸਪੋਟੇਸ਼ਨ ਤੁਸੀਂ ਅ ਕੈਬ ਵੀ ਬੁੱਕ ਕਰ ਸਕਦੇ ਹੋ ਤੁਸੀਂ ਬੱਸਿਸ 'ਤੇ ਵੀ ਜਾ ਸਕਦੇ ਹੋ ਜੇ ਤੁਸੀਂ ਹੋਰ ਵੀ ਆਪਣੇ ਟੂਰ ਨੂੰ ਐਕਸਪਲੋਰ ਕਰਨਾ ਹੈ ਤਾਂ ਤੁਸੀਂ ਬੱਸਿਸ 'ਤੇ ਵੀ ਜਾ ਸਕਦੇ ਹੋ ਟ੍ਰੇਨਸ ਅ ਹਾਂ ਟ੍ਰੇਨਸ ਵੀ ਅਪਲਬ ਉਪਲੱਬਧ ਹੈਗੀਆਂ ਨੇ ਅਤੇ ਜਿਹੜੇ ਕੁਝ ਐਪਸ ਵੀ ਬਣਾਏ ਗਏ ਨੇ ਕੁਝ ਐਪਸ ਵੀ ਬਣਾਏ ਗਏ ਨੇ ਜਿਸ ਨਾਲ ਤੁਸੀਂ ਇਹ ਵਾਲੀ ਬੁਕਿੰਗ ਕਰ ਸਕਦੇ ਹੋ ਤੁਸੀਂ ਔਨਲਾਈਨ ਬੁਕਿੰਗ ਕਰ ਸਕਦੇ ਹੋ ਜੇ ਤੁਸੀਂ ਕਿਤੇ ਮਤਲਬ ਜੇ ਤੁਸੀਂ ਕਿਤੇ ਨਹੀਂ ਜਾਣਾ ਚਾਹ ਰਹੇ ਅਤੇ ਤੁਹਾਨੂੰ ਟਾਈਮ ਲੱਗ ਰਿਹਾ ਤਾਂ ਤੁਸੀਂ ਔਨਲਾਈਨ ਬੁਕਿੰਗ ਕਰ ਸਕਦੇ ਹੋ ਈਜੀਲੀ ਹਾਂਜੀ ਸਰ ਹਾਂਜੀ ਤੁਸੀਂ ਉਨ੍ਹਾਂ ਨੂੰ ਕਹਿ ਦਿਓ ਕਿ ਮੈਂ ਮੈਂ ਸਿਰਫ਼ ਇੰਨੇ ਬਜਟ 'ਚ ਜਾਣਾ ਚਾਹ ਰਿਹਾ ਹਾਂ ਜੇ ਕੋਈ ਹਾਂ ਹੈਗੀਆਂ ਨੇ ਬਹੁਤ ਸਾਰੇ ਪੈਕੇਜਸ ਹੈਗੇ ਨੇ ਜਿਵੇਂ ਕਿ ਲੋਐਸਟ ਲੋਐਸਟ ਪੈਕੇਜ ਵੀ ਹੈਗੇ ਨੇ ਹਿਊਜ ਕੋਸਟ ਵਾਲੇ ਪੈਕੇਜਜ ਵੀ ਹੈਗੇ ਨੇ ਅਤੇ ਜਿਹੜੇ ਕੈਬ ਡ੍ਰਾਈਵਰਸ ਹੁੰਦੇ ਨੇ ਉਨ੍ਹਾਂ ਨੂੰ ਫੇਮਸ ਜਗ੍ਹਾਵਾਂ ਬਾਰੇ ਬਹੁਤ ਨੌਲਿਜ ਹੁੰਦੀ ਹੈ ਅਤੇ ਜੇ ਜੇ ਤੁਸੀਂ ਕਹਿ ਰਹੇ ਹੋ ਤੁਸੀਂ ਫੇਮਸ ਜਗ੍ਹਾ ਜਾ ਰਹੇ ਹੋ ਤਾਂ ਉਹ ਤੁਹਾਨੂੰ ਈਜ਼ਿਲੀ ਪਹੁੰਚਾ ਦੇਣਗੇ ਉਨ੍ਹਾਂ ਨੂੰ ਹਾਂਜੀ ਹਾਂਜੀ ਸੇਫਲੀ ਹੈ ਇਹਦੇ 'ਚ ਕੋਈ ਨੁਕਸਾਨ ਨਹੀਂ ਹੈਗਾ ਕੋਈ ਇਹ 'ਚ ਆਪਾਂ ਡਰਨ ਵਾਲੀ ਗੱਲ ਨਹੀਂ ਕਹਿ ਸਕਦੇ ਇਹ 'ਚ ਕੋਈ

ਹਾਂਜੀ ਸਭ ਸਿਕਿਓਰਡ ਹੈ ਸਰ ਅਤੇ ਜੇ ਕੋਈ ਜੇ ਕੋਈ ਜੇ ਕੋਈ ਤੁਹਾਨੂੰ ਕਹਿ ਜੇ ਮੰਨ ਲਓ ਜੇ ਤੁਸੀਂ ਬੁਕਿੰਗ ਕੀਤੀ ਹੈ ਅਤੇ ਤੁਸੀਂ ਉਹਨੂੰ ਕੈਂਸਲ ਕਰਨਾ ਚਾਹ ਰਹੇ ਹੋ ਜੇ ਕੋਈ ਕੈਂਸਲ ਨਹੀਂ ਵੀ ਕਰ ਰਿਹਾ ਫਿਰ ਵੀ ਕੋਈ ਦਿੱਕਤ ਨਹੀਂ ਹੈਗੀ ਦਿੱਕਤ ਵਾਲੀ ਗੱਲ ਨਹੀਂ ਹੈਗੀ

ਹਾਂ ਠੀਕ ਹੈ ਧੰਨਵਾਦ